ਜੀ ਹਾਂ ਮੇਰੇ ਕੋਲ ਇੱਕ ਕਿਤਾਬ ਹੈ ਜਿਸਦਾ ਨਾਮ ਹੈ ਇੱਕੀਵੀਂ ਸਦੀ ਦਾ ਕਾਰੋਬਾਰ ਇਹ ਮੈਂ ਕਈ ਵਾਰ ਪੜ੍ਹੀ ਹੈ ਇਹ ਕੀ ਹੈ ਤਾਂ ਇਹਦਾ ਜਵਾਬ ਇਹ ਹੈ ਕਿ ਇਸ ਕਿਤਾਬ ਦੇ ਵਿੱਚ ਜੋ ਆਉਣ ਵਾਲੇ ਸਮੇਂ ਦਾ ਕਾਰੋਬਾਰ ਹੈ ਇਸ ਇੱਕੀਵੀਂ ਸਦੀ ਦਾ ਕਾਰੋਬਾਰ ਹੈ ਦੋ ਹਜ਼ਾਰ ਇੱਕ ਤੋਂ ਲੈ ਕੇ ਦੋ ਹਜ਼ਾਰ ਤੀਹ ਤੱਕ ਇੱਕੀ ਸੌ ਤੱਕ ਤਾਂ ਉਸ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ ਦਾ ਜਿਹੜਾ ਧੰਦਾ ਹੈ ਉਹ ਨੈੱਟਵਰਕ ਮਾਰਕੀਟਿੰਗ ਹੈ ਉਸ ਦੇ ਸੰਬੰਧ 'ਚ ਉਹ ਕਿਤਾਬ ਲਿਖੀ ਗਈ ਹੈ ਇਹ ਕਿਤਾਬ ਮਿਸਟਰ ਰੋਬਟ ਕੇ ਸਾਖੀ 'ਤੇ ਲਿਖੀ ਹੋਈ ਹੈ ਜਿੰਨ੍ਹਾਂ ਦਾ ਜਿਹੜਾ ਪਿਛੋਕੜ ਆ ਉਹ ਜਪਾਨ ਦਾ ਹੈਗਾ ਅਤੇ ਇਸ ਵੇਲੇ ਅਮੈਰੀਕਾ ਦੇ ਵਿੱਚ ਉਹ ਰਹਿੰਦੇ ਹੈਗੇ ਆ ਤਾਂ ਉਹ ਲੋਕਾਂ ਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਦਿੰਦੇ ਆ ਅਤੇ ਮੈਂ ਇਹ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਕਿਤਾਬਾਂ ਹੋਰ ਲੋਕਾਂ ਨੂੰ ਵੀ ਪੜ੍ਹਨੀਆਂ ਚਾਹੀਦੀਆਂ ਅਤੇ ਇਸ ਦੇ ਉੱਤੇ ਜੇ ਕੋਈ ਫਿਲਮ ਬਣਦੀ ਹੈ ਤਾਂ ਮੈਂ ਉਹ ਜ਼ਰੂਰ ਦੇਖਣੀ ਚਾਹੂੰਗਾ ਕਿਉਂਕਿ ਸਾਨੂੰ ਆਉਣ ਵਾਲੇ ਸਮੇਂ 'ਚ ਜਿਹੜੀਆਂ ਨੌਕਰੀਆਂ ਜਾਂ ਹੋਰ ਉਹ ਧੰਦੇ ਆ ਜਿਹੜੇ ਆਮ ਕਾਰੋਬਾਰ ਦੇ ਉਹ ਬੰਦ ਹੋਣ ਜਾ ਰਹੇ ਹੈਗੇ ਆ ਈਕੋਮੀਕਲੀ ਹਾਲਤ ਹੈ ਜਿਹੜੀ ਉਹ ਖਸਤਾ ਹੋ ਰਹੀ ਹੈ ਅਤੇ ਆਉਣ ਵਾਲਾ ਧੰਦਾ ਜਿਹੜਾ ਇੱਕੀਵੀਂ ਸਦੀ ਦਾ ਕਾਰੋਬਾਰ ਨੈੱਟਵਰਕ ਮਾਰਕੀਟਿੰਗ ਹੈ ਇਸ ਦੇ ਉੱਤੇ ਮੈਂ ਫਿਲਮ ਜ਼ਰੂਰ ਦੇਖਣੀ ਚਾਹੂੰਗਾ